ਹੈਲੋ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੈਮ ਪੋਸਟ ਆਫਿਸ ਤੋਂ ਬੋਲ ਰਹੇ ਹਾਂ ਜੀ ਠੀਕ ਹੈ ਮੈਮ ਅੱਛਾ ਜੀ ਮੈਮ ਮੈਮ ਨਾ ਉਹ ਡਿਸਪੈਜ ਹੋ ਗਿਆ ਇੱਥੋਂ ਦੋ ਦਿਨ ਹੋ ਗਏ ਜੀ ਹਾਂਜੀ ਹਾਂਜੀ ਹਾਂਜੀ ਮੈਮ ਉੱਥੇ ਭੇਜਿਆ ਗਿਆ ਵਾ ਉਹ ਕੋਈ ਗੱਲ ਨਹੀਂ ਮੈਮ ਇੱਕ ਮਿੰਟ ਵੇਟ ਕਰੋ ਮੈਂ ਚੈੱਕ ਕਰਕੇ ਦੱਸਦਾ ਜੀ ਮੈਮ ਹਾਂ ਮੈਂ ਮਾਡਲ ਟਾਊਨ ਕੇ ਕੇ ਰੋਡ ਹਾਂ ਐਡਰੈਸ ਤਾਂ ਸਹੀ ਆ ਰਿਹਾ ਬਟ ਹਾਂ ਇਹ ਡਿਸਪੈਚ ਹੋ ਗਿਆ ਜੀ ਇੱਥੋਂ ਤੁਹਾਡਾ ਜੋ ਕੂਰੀਅਰ ਸੀਗਾ ਇਹ ਇੱਥੋਂ ਹੋ ਗਿਆ ਡਿਸਪੈਚ ਹੋ ਗਿਆ ਜੀ ਠੀਕ ਹੈ ਮੈਮ ਕੋਈ ਗੱਲ ਨਹੀਂ ਮੈਮ ਅੱਛਾ ਜੀ ਕੋ ਕੋਈ ਗੱਲ ਨਹੀਂ ਮੈਮ ਮੈਂ ਚੈੱਕ ਕਰਦਾ ਜੀ ਬਾਕੀ ਪੋਸਟਮੈਨ ਆਉਣਗੇ ਮੈਂ ਉਹਨਾਂ ਨੂੰ ਪੁੱਛੂਗਾ ਵੀ ਅਗਰ ਉਹ ਅਨਕਲੇਮਡ ਹੋ ਗਿਆ ਨਾ ਅਤੇ ਫਿਰ ਤੁਹਾਡੇ ਨਿਊ ਡਰੈਸ 'ਤੇ ਪਹੁੰਚਾ ਦਿੱਤਾ ਜਾਵੇਗਾ ਬਾਕੀ ਮੈਮ ਹਜੇ ਕੁਛ ਮੈਂ ਇਨਫੋਰਮੇਸ਼ਨ ਦੇ ਨਹੀਂ ਸਕਦਾ ਇਹਦੇ ਬਾਰੇ ਕਿਉਂਕਿ ਪੋਸਟਮੈਨ ਆਉਣਗੇ ਨਾ ਜੋ ਉਸ ਸਾਈਡ ਤੁਹਾਡੇ ਏਰੀਏ ਵੱਲ ਪੋਸਟਮੈਨ ਹੈ ਜੀ ਮੈਂ ਉਹਦੇ ਤੋਂ ਪੁੱਛੂਗਾ ਬਾਕੀ ਤੁਸੀਂ ਮੈਮ ਹਾਂਜੀ ਹਾਂਜੀ ਬੋਲੋ ਠੀਕ ਹੈ ਜੀ ਓਕੇ ਓਕੇ ਓਕੇ ਮੈਮ ਕੋਈ ਗੱਲ ਨਹੀਂ ਮੈਮ ਬਾਕੀ ਮੈਮ ਤੁਸੀਂ ਕੱਲ੍ਹ ਨੂੰ ਇੱਦਾਂ ਕਰੋ ਤੁਸੀਂ ਪੋਸਟ ਆਫਿਸ ਹੀ ਆ ਜਾਇਓ ਜੀ ਅਤੇ ਮੈਨੂੰ ਆ ਕੇ ਆਪਣਾ ਐਡਰੈਸ ਦੱਸ ਦਿਓ ਜੀ ਅਤੇ ਬਾਕੀ ਪੁਰਾਣੇ ਐਡਰੈਸ 'ਤੇ ਬਾਕੀ ਤੁਹਾਡਾ ਪੋ ਜੋ ਪਹੁੰਚਿਆ ਕੁਰੀਅਰ ਉਹਦੇ ਰਿਗਾਰਡਿੰਗ ਆਪਾਂ ਗੱਲਬਾਤ ਕਰ ਲਾਂਗੇ ਬੈਠ ਕੇ ਵੀ ਉਹ ਪੋਸਟਮੈਨ ਵੀ ਇੱਥੇ ਹੋਵੇਗਾ ਮੋਰਨਿੰਗ ਤਾਂ ਕਰਕੇ ਫਿਰ ਤੁਹਾਨੂੰ ਉਹਦੇ ਸਾਹਮਣੇ ਕਲੈਰਟੀ ਹੋ ਜੂਗੀ ਜੀ ਉਹ ਮੈਮ ਐਕਚੁਲੀ ਨਾ ਹੁਣ ਵਰਕ ਜ਼ਿਆਦਾ ਹੁੰਦਾ ਜੀ ਵਰਕ ਲੋਡ ਹੋਣ ਕਰਕੇ ਕਈ ਵਾਰ ਕੋਲਸ ਪਿੱਕ ਨਹੀਂ ਹੋ ਪੋ ਪਾਉਂਦੀਆਂ ਸੋ ਉਹਦੇ ਲਈ ਅਸੀਂ ਮਾਫ਼ੀ ਚਾਹਾਂਗੇ ਮੈਮ ਠੀਕ ਏ ਮੈਮ ਕੋਈ ਗੱਲ ਨਹੀਂ ਤੁਸੀਂ ਕੱਲ੍ਹ ਨੂੰ ਮੈਮ ਪੋਸਟ ਆਫਿਸ ਆ ਜਾਇਓ ਅਤੇ ਆਪਾਂ ਇੱਥੇ ਤੁਹਾਡੀ ਬਹਿ ਕੇ ਹੈਲਪ ਕਰ ਦਾਂਗੇ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਮੈਮ